ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਮ ਦੱਸੋ ਹਾਂਜੀ ਹਾਂਜੀ ਮੈਂ ਇੱਥੋਂ ਦੀ ਹਾਂ ਇਹ ਮੇਰਾ ਹੀ ਘਰ ਹੈ ਹਾਂਜੀ ਹਾਂਜੀ

ਹਾਂਜੀ ਇੱਕ ਗੱਲ ਪੁੱਛਣੀ ਸੀ ਇਹਦੇ ਵਿੱਚ ਮੈਮ ਇਹ ਜਿਹੜੀ ਤੁਸੀਂ ਪਲਾਟਿੰਗ ਆ ਇਹਦੇ ਵਿੱਚ ਤੁਸੀਂ ਸਪੈਸ਼ਲ ਓਫਰ ਵੀ ਦੇ ਰਹੇ ਹਾਂ ਕਿ ਟ੍ਰੀ ਪ੍ਰੋਵਾਈ ਡ ਕਰ ਰਹੇ ਹਾਂ ਟ੍ਰੀ ਪਲਾਂਟਿੰਗ ਲਈ ਹਾਂਜੀ ਮੈਮ ਹਾਂਜੀ ਅਤੇ ਮੈਮ ਇਹਦੇ ਵਿੱਚ ਸਾਨੂੰ ਫਲਾਵਰਸ ਵਗੈਰਾ ਵਾਲੇ ਪਲਾਂਟ ਵੀ ਮਿਲਣਗੇ ਕਿ ਸਿਰਫ ਇਹਨਾਂ ਦਾ ਪ੍ਰਾਈਜ਼ ਮੈਮ ਸਾਨੂੰ ਕੀ ਪੈ ਜਾਏਗਾ ਦੱਸ ਸਕਦੇ ਹੋ ਤੁਸੀਂ ਮੈਮ ਆਹ ਤੁਹਾਡੇ ਸਾਹਮਣੇ ਹੀ ਜਗ੍ਹਾਂ ਹੈ ਇੱਥੇ ਤੁਸੀਂ ਦੇਖ ਲਓ ਮੇਰੇ ਖਿਆਲ 'ਚ ਤਾਂ ਪੰਜ ਤੋਂ ਛੇ ਆ ਜਾਣਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਮੈਂ ਜ਼ਰੂਰ ਇਸ ਮੁਹਿੰਮ ਵਿੱਚ ਹਿੱਸਾ ਲੈਣਾ ਚਾਹੂੰਗੀ ਬਿਕੋਜ਼ ਇਹ ਸਾਡੇ ਲਈ ਬਹੁਤ ਵਧੀਆ ਕਿਉਂਕਿ ਅੱਜ ਤੁਹਾਨੂੰ ਪਤਾ ਹੀ ਹੈ ਕਿੰਨਾ ਪਲੂਸ਼ਨ ਹੋ ਰਿਹਾ ਕਿੰਨੀ ਸਾਨੂੰ ਨੀਂਡ ਹੈ ਇਨਵਾਰਮੈਂਟ ਦੀ ਇਹ ਸਾਰਾ ਕੁਛ ਪੋਸੀਬਲ ਤਾਂ ਹੀ ਹੋਏਗਾ ਜੇ ਅਸੀਂ ਵੀ ਇਹਦੇ ਵਿੱਚ ਜੁੜਾਂਗੇ ਕਿਉਂਕਿ ਬੂੰਦ ਬੂੰਦ ਨਾਲ ਕਹਿੰਦੇ ਹੁੰਦੇ ਆ ਸਾਗਰ ਭਰਦਾ ਹੈ ਹਾਂਜੀ ਜ਼ਰੂਰ ਜੀ ਹਾਂਜੀ ਹਾਂਜੀ ਮੈਮ ਮੈਨੂੰ ਤੁਸੀਂ ਟਾਈਮ ਦੱਸ ਦਿਓ ਤਾਂ ਕਿ ਮੈਂ ਆਪਣੇ ਨੇਬਰਹੁੱਡ ਨੂੰ ਵੀ ਇਸ ਚੀਜ਼ ਬਾਰੇ ਰਿਵੇਅਰਨੈਸ ਦੱਸ ਸਕਾ ਹਾਂਜੀ ਓਕੇ ਜੀ ਥੈਂਕ ਯੂ ਥੈਂਕ ਯੂ ਮੈਮ